ਨਵੇਂ ਜੰਮੇ ਬੱਚੇ ਦੀ ਖੁਰਾਕ ਪਹਿਲੇ ਛੇ ਮਹੀਨੇ ਸਿਰਫ ਮਾਂ ਦਾ ਦੁੱਧ ਹੋਣਾ ਚਾਹੀਦਾ ਕਿਉਂਕਿ ਬੱਚੇ ਦੀ ਪਾਚਨ ਸ਼ਕਤੀ ਇੰਨੀ ਨਹੀਂ ਹੁੰਦੀ ਕਿ ਉਹ ਸਾਰੀਆਂ ਚੀਜ਼ਾਂ ਨੂੰ ਪਚਾ ਸਕੇ ਇਸ ਲਈ ਉਸ ਦੀ ਪਹਿਲੇ ਛੇ ਮਹੀਨਿਆਂ ਦੀ ਖੁਰਾਕ ਸਿਰਫ ਮਾਂ ਦਾ ਦੁੱਧ ਹੋਣੀ ਚਾਹੀਦੀ ਹੈ ਅਤੇ ਇਸ ਵਿੱਚ ਸਾਰੇ ਪੋਸ਼ਟਿਕ ਆਹਾਰ ਮੌਜੂਦ ਹੁੰਦੇ ਹਨ ਕਿਉਂਕਿ ਮਾਂ ਜੋ ਭੋਜਨ ਖਾਂਦੀ ਹੈ ਉਸ ਦਾ ਸਾਰਾ ਪੋਸ਼ਣ ਦੁੱਧ ਵਿੱਚ ਰਹਿ ਜਾਂਦਾ ਅਤੇ ਉਹ ਬੱਚੇ ਨੂੰ ਮਿਲ ਜਾਂਦਾ ਹੈ ਅਤੇ ਇਸ ਤੋਂ ਬਾਅਦ ਛੇ ਤੋਂ ਅੱਠ ਮਹੀਨੇ ਮਾਂ ਦਾ ਦੁੱਧ ਅਤੇ ਨਾਲ ਸਬਜ਼ੀਆਂ ਅਤੇ ਫਲਾਂ ਦਾ ਸੂਪ ਬੱਚੇ ਨੂੰ ਦਿੱਤਾ ਜਾ ਸਕਦਾ ਹੈ ਉਸ ਤੋਂ ਬਾਅਦ ਅੱਠ ਤੋਂ ਬਾਰ੍ਹਾਂ ਮਹੀਨਿਆਂ ਦੇ ਬੱਚੇ ਨੂੰ ਮਾਂ ਦਾ ਦੁੱਧ ਅਤੇ ਨਾਲ ਸਬਜ਼ੀਆਂ ਅਤੇ ਫਲਾਂ ਦਾ ਸੂਪ ਅਤੇ ਨਾਲ ਹੀ ਸ਼ਹਿਦ ਦੀ ਵਰਤੋਂ ਕਰ ਸਕਦੇ ਹਾਂ